ਜੀ ਹਾਂ ਮੈਂ ਡਿਜੀਟਲ ਡਰਾਇੰਗ ਟੂਲਸ ਦੇ ਨਾਲ ਆਪਣਾ ਅਨੁਭਵ ਸਾਂਝਾ ਕਰ ਸਕਦਾ ਹਾਂ ਮੈਨੂੰ ਯਾਦ ਹੈ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਅਸੀਂ ਕੋਈ ਵੀ ਡਰਾਇੰਗ ਵਗੈਰਾ ਜਾਂ ਕੁਛ ਵੀ ਕਰਨਾ ਪੈਂਦਾ ਸੀ ਉਸ ਦੇ ਵਿੱਚ ਸਾਨੂੰ ਕਿੰਨੀ ਦੇਰ ਤੀਕਰ ਕਿੰਨੇ ਕਿੰਨੇ ਘੰਟੇ ਉਹਦੇ ਉੱਪਰ ਬਰੀਕੀ ਤੋਂ ਬਰੀਕੀ ਦੇ ਨਾਲ ਕੰਮ ਕਰਨਾ ਪੈਂਦਾ ਸੀ ਪਰ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਆਪਾਂ ਦੇਖੀਏ ਆਪਾਂ ਕੰਪਿਊਟਰ ਦੀ ਵਰਤੋਂ ਕਰਕੇ ਆਪਾਂ ਉਹਦੇ ਉੱਪਰ ਕੋਈ ਵੀ ਡਰਾਇੰਗ ਬੜੇ ਹੀ ਆਸਾਨੀ ਦੇ ਨਾਲ ਬਣਾ ਸਕਦੇ ਹਾਂ ਅਤੇ ਉਹ ਜਿਹੜੀ ਡਰਾਇੰਗ ਆਪਾਂ ਹੁਣ ਬਣਾ ਸਕਦੇ ਹਾਂ ਉਹ ਇੰਨੀ ਬਰੀਕ ਤੋਂ ਬਰੀਕ ਚੀਜ਼ਾਂ ਵੀ ਆਪਾਂ ਬਣਾ ਸਕਦੇ ਹਾਂ ਨਾ ਜੋ ਕਿ ਸ਼ਾਇਦ ਇੱਕ ਆਪਾਂ ਪੁਰਾਣੇ ਜ਼ਮਾਨੇ ਦੇ ਵਿੱਚ ਹੱਥਾਂ ਦੇ ਨਾਲ ਨਾ ਬਣਾ ਪਾਂਦੇ ਅੱਜ ਕੱਲ੍ਹ ਤਾਂ ਇਹ ਵੀ ਇੱਕ ਬਹੁਤ ਵੱਡੀ ਸ਼ ਸਾਨੂੰ ਫਾਇਦਾ ਮਿਲ ਚੁੱਕਾ ਹੈ ਕਿ ਜਿਹੜੀ ਵੀ ਆਪਾਂ ਡਰਾਇੰਗ ਡਿਜੀਟਲੀ ਕਰੀਦੀ ਹੈ ਉਹਨੂੰ ਆਪਾਂ ਕੰਪਿਊਟਰ ਦੇ ਰਾਹੀਂ ਪ੍ਰਿੰਟਰ ਦੇ ਥਰੂ ਉਹਨੂੰ ਪ੍ਰਿੰਟ ਵੀ ਉਹੋ ਜਿਹਾ ਹੀ ਕੱਢ ਸਕਦੇ ਹਾਂ ਮੇਰੇ ਹਿਸਾਬ ਦੇ ਨਾਲ ਡਰਾਇੰਗ ਡਿਜੀਟਲ ਟੂਲਸ ਹੈ ਜਿਹੜੇ ਉਹਨਾਂ ਨੇ ਬਹੁਤ ਜ਼ਿਆਦਾ ਗਿਆਨ ਵਾਧਾ ਕੀਤਾ ਹੈ ਇਸ ਟਾਈਮ ਦੇ ਉੱਪਰ